ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮੀਡੀਆ ਜਿਵੇਂ ਰੇਡੀਓ ਟੈਲੀਵੀਜ਼ਨ ਅਤੇ ਪਰਿੰਟਸ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਾਫ਼ੀ ਹੱਦ ਤੱਕ ਕੀਤੀ ਜਾਂਦੀ ਹੈ ਲੇਕਿਨ ਕਾਫ਼ੀ ਹੱਦ ਤੱਕ ਨਹੀਂ ਵੀ ਕੀਤੀ ਜਾਂਦੀ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਸਿਰਫ ਇਨ੍ਹਾਂ ਨੇ ਇੱਕ ਹਿਸਾਬ ਨਾਲ ਇੰਟਰਟੇਨਮੈਂਟ ਸੋਰਸ ਬਣਾ ਦਿੱਤਾ ਗਿਆ ਹੈ ਜਿਵੇਂ ਗਾਣੇ ਚੱਲਦੇ ਨੇ ਪੰਜਾਬੀ ਫ਼ਿਲਮਾਂ ਚੱਲਦੀਆਂ ਨੇ ਪੀ ਟੀ ਸੀ ਚੈੱਨਲ ਹੈ ਜੋ ਫ਼ੀ ਇੰਟਰਨੈਸ਼ਨਲ ਲੈਵਲ 'ਤੇ ਮਸ਼ਹੂਰ ਹੈਗਾ ਅਤੇ ਜਿਸ ਤਰ੍ਹਾਂ ਅਸੀਂ ਆਮ ਗੱਲ ਕਰੀਏ ਕਿ ਅਸੀਂ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਕੋਈ ਐਡ ਐਡਵਟਾਇਸਮੈਂਟ ਕਿਸੇ ਨੇ ਕਰਨੀ ਹੈ ਉਹ ਦੂਸਰੀ ਲੈਂਗੂਏਜ਼ ਦੇ ਨੂੰ ਪਰੈਫਰ ਕਰਨਗੇ ਪੰਜਾਬੀ ਭਾਸ਼ਾ ਨੂੰ ਪਰੈਫਰ ਨਹੀਂ ਕਰਨਗੇ ਉਹ ਇੰਗਲਿਸ਼ ਜਾਂ ਹਿੰਦੀ ਦੇ ਨਾਲ ਉਸ ਐਡਵਟਾਇਜ਼ਮੈਂਟ ਨੂੰ ਵਧਾਵਾ ਦਿੰਦੇ ਨੇ ਜੋ ਕਿ ਪੰਜਾਬੀ ਭਾਸ਼ਾ ਵੀ ਆਪਾਂ ਵਰਤੋਂ ਕਰ ਸਕਦੇ ਹਾਂ ਜਿਸ ਤਰ੍ਹਾਂ ਹੁਣ ਆਮ ਅਸੀਂ ਸਕੂਲਾਂ ਦੀ ਵੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੀ ਹੁਣ ਹੂਣ ਆ ਕੇ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਤੁਸੀਂ ਬੋਲੋ ਇੰਗਲਿਸ਼ ਹਿੰਦੀ ਉਹਨੂੰ ਇੱਕ ਐਜ ਅ ਸਬਜੈਕਟ ਰੱਖੋ ਪੰਜਾਬ ਵਿੱਚ ਕਾਫੀ ਹੱਦ ਤੱਕ ਪੰਜਾਬੀ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ ਜੋ ਕਿ ਕਾਫ਼ੀ ਗਲਤ ਗੱਲ ਹੈ ਪੰਜਾਬੀ ਇੱਕ ਸਾਡੀ ਮਾਂ ਬੋਲੀ ਹੈ ਜਿਹਦੇ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਧੰਨਵਾਦ